ਘੱਟ ਸਮੇਂ ਹੋਣ ਕਾਰਨ ਅਸੀਂ ਫਰੂਟ ਦੀ ਚਾਟ ਵਗੈਰਾ ਬਣਾ ਕੇ ਵੀ ਯੂਸ ਕਰ ਸਕਦੇ ਹਾਂ ਪਾਸਤਾ ਹੋਇਆ ਮੈਕਰੋਨੀ ਵਗੈਰਾ ਬਣਾ ਲਈ ਹੈ ਨਾ ਅਤੇ ਠੀਕ ਮਿਲਕ ਸ਼ੇਕ ਜੂਸ ਜਾਂ ਫਿਰ ਸੂਪ ਵਗੈਰਾ ਬਣਾ ਕੇ ਆਪਣਾ ਭੋਜਨ ਕਰ ਸਕਦੇ ਹਾਂ ਅਤੇ ਘੱਟ ਸਮੇਂ ਵਿੱਚ ਨਮਕੀਨ ਚਾਵਲ ਵਗੈਰਾ ਬਣਾ ਲਏ ਦਹੀਂ ਰਾਇਤਾ ਹੋ ਗਿਆ ਅਤੇ ਇੱਕ ਆਪਾਂ ਕੋਈ ਵੀ ਕਿਸੇ ਤਰ੍ਹਾਂ ਦੀ ਨਮਕੀਨ ਵਗੈਰਾ ਬਿਸਕਿਟ ਕੋਫੀ ਬਣਾ ਕੇ ਉਹਦੇ ਨਾਲ ਵੀ ਲੈ ਕੇ ਆਪਣਾ ਜਿਹੜਾ ਹੈ ਭੋਜਨ ਦੀ ਥਾਂ 'ਤੇ ਆਪਣਾ ਪੇਟ ਨੂੰ ਭਰ ਸਕਦੇ ਹਾਂ